ਹਾਂ ਭੰਗੜੇ ਦੇ ਸਟੈਪਾਂ ਬਾਰੇ ਜੇ ਅਸੀਂ ਗੱਲ ਕਰੀਏ ਤਾਂ ਭੰਗੜੇ ਦੇ ਜਿਹੜੇ ਜਿਹੜੇ ਬਹੁਤ ਹੀ ਅੱਛੇ ਸਟੈਪ ਨੇ ਪਟਾਕਾ ਕਹਿ ਸਕਦੇ ਹਾਂ ਅਸੀਂ ਧਮਾਲ ਕਹਿ ਸਕਦੇ ਹਾਂ ਅਸੀਂ ਲੁੱਡੀ ਬਾਰੇ ਸੋਚ ਸਕਦੇ ਹਾਂ ਝੂਮਰ ਹੁੰਦਾ ਇਹਦਾ ਔਰ ਚਾਲ ਤੁਗਣਾ ਵੀ ਹੁੰਦਾ ਇਆ ਤਾਂ ਇਸ ਲਈ ਜ ਭੰਗੜੇ ਦੇ ਆਮ ਸਟੈਪ ਹਨ ਪਰ ਅਸੀਂ ਪੰਜਾਬੀ ਸੱਭਿਆਚਾਰਕ ਵਿੱਚ ਜ਼ੋਰਦਾਰ ਤਰੀਕੇ ਨਾਲ ਇਸ ਨੂੰ ਇਸ ਲਈ ਜਸ਼ਨ ਅਤੇ ਸੁਭਾਅ ਵਿੱਚ ਯੋਗਦਾਨ ਪਾਉਂਦੇ ਹੈ ਇਸ ਲਈ ਪਾਉਂਦੇ ਹਾਂ ਕਿਉਂਕਿ ਸਾਡੀ ਪੰਜਾਬੀ ਪੰਜਾਬੀਅਤ ਦੇ ਹੋਣ ਦੇ ਨਾਤੇ ਪੰਜਾਬ ਸ਼ਹਿਰ ਹੋਣ ਦੇ ਬਾ ਨਾਤੇ ਪੰਜਾਬ ਦਾ ਜ ਅ ਸਟੇਟ ਜਿਹੜੀ ਹੈ ਪੰਜਾਬੀਅਤ ਹੈ ਜਿਹਦੇ ਵਿੱਚ ਇਹਦਾ ਇਹ ਸੱਭਿਆਚਾਰਕ ਹਰ ਜੋਗ ਹਰ ਸੱਭਿਆਚਾਰਕ ਸਮੇਂ ਫੰਕਸ਼ਨ ਉੱਤੇ ਜਿਹੜਾ ਆਪਾਂ ਭੰਗੜੇ ਹੈ ਨਾ ਇਹ ਪਾਉਣਾ ਬਹੁਤ ਹੀ ਅੱਛਾ ਲੱਗਦਾ ਆ ਲੋਕ ਇਹਨੂੰ ਪਸੰਦ ਕਰਦੇ ਨੇ ਔਰ ਬੱਚਿਆਂ ਦੇ ਬੱਚਿਆਂ ਦੀ ਇਹ 'ਚ ਇਹਦੀ ਕਲਾਸ ਦੇ ਵਿੱਚ ਪੀਰੀਅਡ ਵੀ ਹੁੰਦਾ ਹੈ ਭੰਗੜੇ ਦਾ ਤਾਂ ਜਿਹੜੇ ਜੇ ਬੱਚੇ ਹੋਣਹਾਰ ਹੁੰਦੇ ਜਾਂ ਜਿਹਨਾਂ ਦਾ ਕੱਦ ਬਹੁਤ ਲੰਬਾ ਹੁੰਦਾ ਅੱਛੇ ਸਿਹਤ ਵਾਲੇ ਹੁੰਦੇ ਆ ਉਹ ਇਹਦੇ ਵਿੱਚ ਯੋਗਦਾਨ ਆਪਣਾ ਪੂਰੀ ਤਰ੍ਹਾਂ ਲੈਂਦੇ ਨੇ ਔਰ ਉਨ੍ਹਾਂ ਨੂੰ ਅਖੀਰ ਵਿੱਚ ਫਿਰ ਪ੍ਰਾਈਜ ਵੀ ਮਿਲਦੇ ਨੇ ਉਨ੍ਹਾਂ ਦੀ ਇਸ ਅੱਛੇ ਕੰਮ ਦੇ ਕੱਦ ਕਾਰਨ ਉਨ੍ਹਾਂ ਨੂੰ ਪ੍ਰਾਈਜ ਮਿਲਦੇ ਨੇ ਇਸ ਲਈ ਭੰਗੜੇ ਦੇ 'ਚ ਸੁਭਾਅ ਦੇ ਵਿੱਚ ਹਰ ਇੱਕ ਦੇ ਵਿੱਚ ਨਹੀਂ ਹੁੰਦਾ ਕੋਈ ਕੋਈ ਬੱਚਾ ਭੰਗੜਾ ਪਾ ਸਕਦਾ ਜਿਹਦੇ ਵਿੱਚ ਉਹ ਜਸ਼ ਜੋ ਜਨੂੰਨ ਹੁੰਦਾ ਭੰਗੜੇ ਪਾਉਣ ਦਾ ਜ਼ਿਆਦਾਤਰ ਜਿਹੜੇ ਭੰਗੜੇ ਵਾਲੇ ਬੱਚੇ ਹੁੰਦੇ ਆ ਉਹ ਪਿੰਡਾਂ ਵਿੱਚ ਦੇ ਜਿਹੜੇ ਹੁੰਦੇ ਆ ਖੁੱਲ੍ਹੇ ਪਰਿਵਾਰਾਂ ਦੇ ਹੈਂਅ ਜਿ ਜੱਟ ਜਿਮੀਦਾਰ ਪਰਿਵਾਰਾਂ ਦੇ ਬੱਚੇ ਉਹ ਵੀ ਭੰਗੜੇ ਦੇ ਯੋਗਦਾਨ ਪਾਉਂਦੇ ਹੈ ਤਾਂ ਕਿ ਉਹ ਉਨ੍ਹਾਂ ਦਾ ਜਿਹੜੀ ਸਿਹਤਾਂ ਵੀ ਅੱਛੀਆਂ ਹੁੰਦੀਆਂ ਕੱਦ ਲੰਬੇ ਹੁੰਦੇ ਨੇ ਭੰਗੜੇ ਵਿੱਚ ਉਹ ਹੀ ਬੱਚੇ ਅੱਛੇ ਲੱਗਦੇ ਜਿਹਨਾਂ ਦੇ ਕੱਦ ਲੰਬੇ ਸਿਹਤਾਂ ਅੱਛੀਆਂ ਹੋਣ ਔਰ ਤੰਦਰੁਸਤੀ ਹੋਵੇ ਤਾਂ ਉਹੀ ਭੰਗੜੇ ਪਾਉਂਦੇ ਨੇ ਔਰ ਹਰ ਫੰਕਸ਼ਨ 'ਤੇ ਜਿੱਦਾਂ ਛੱਬੀ ਜਨਵਰੀ ਲਾ ਲਓ ਪੰਦਰਾਂ ਅਗਸਤ ਲਾ ਲਓ ਅੱਛੇ ਅੱਛੇ ਫੰਕਸ਼ਨਾਂ ਵਿੱਚ ਯੋ ਯੋਗਦਾਨ ਆਪਣਾ ਦਿੰਦੇ ਨੇ ਔਰ ਸੱਭਿਆਚਾਰਕ ਮੇਲਿਆਂ ਉੱਤੇ ਸੱਭਿਆਚਾਰਕ ਪ੍ਰੋਗਰਾਮਾਂ ਉੱਤੇ ਆਪਣੇ ਭੰਗੜੇ ਦੀ ਖੂਸ਼ ਅ ਖੂਬ ਖੁ ਖੁ ਖੁਸ਼ੀਆਂ ਦੇ ਨਾਲ ਖੂਬ ਰਹਿਨੁਮਾਈ ਕਰਦੇ ਨੇ ਔਰ ਭੰਗੜਾ ਖੂਬ ਪਾਉਂਦੇ ਨੇ ਔਰ ਆਨੰਦ ਲੈਂਦੇ ਨੇ